ਪੰਜਾਬੀ ਭੰਗੜਾ ਲੋਕ ਕਰਨ ਦੀ ਲੋਕਾਂ ਦੀ ਗਲਤ ਧਾਰਨਾ ਗਲਤ ਧਾਰਨਾ ਇਸ ਕਰਕੇ ਵੀ ਹੈ ਕਿ ਲੋਕ ਜਿਵੇਂ ਕਿ ਭੰਗੜਾ ਵਿੱਚ ਉਤਸ਼ਾਹ ਦਿਖਾਉਣਾ ਉੱਚੀ ਉੱਚੀ ਚੀਕਣਾ ਚਿੱਲਾਨਾ ਹੋਰ ਕਈ ਲੋਕਾਂ ਦੀ ਧਾਰਨਾ ਹੈਗੀ ਆ ਬੇਵਜਾਹ ਉੱਚੀ ਉੱਚੀ ਚੀਕਣਾ ਚਿੱਲਾਨਾ ਹੈ ਜੋ ਕਿ ਸਾਨੂੰ ਆਪਣੀ ਸੱਭਿਅਤਾ ਦੀ ਜਨਤਾ 'ਤੇ ਜਾਂ ਨਕਾਰ ਦੇਣੀ ਚਾਹੀਦੀ ਹੈ ਕਿ ਫ ਕੀ ਇਹ ਸਾਡੇ ਸੱਭਿਆਚਾਰ ਨਾਲ ਜੁੜਿਆ ਹੋਇਆ ਇੱਕ ਨ ਪੰਜਾਬੀ ਲੋਕ ਨ੍ਰਿਤ ਹੈ ਜਿਹਦੇ ਕਾਰਨ ਸਾਨੂੰ ਲੋਕਾਂ ਨੂੰ ਜਾ ਜਾਗਰੂਕਤਾ ਦਿਖਾਉਣੀ ਚਾਹੀਦੀ ਹੈ ਕਿ ਉਹਨਾਂ ਨੂੰ ਦਿਖਾਉਣਾ ਚਾਹੀਦਾ ਹੈ ਕਿ ਭੰਗੜਾ ਸਾਡਾ ਇੱਕ ਲੋਕ ਡਾ ਨ੍ਰਿਤ ਹੈ ਜਿਹਦੇ ਵਿੱਚ ਜ਼ਿਆਦਾ ਉਤਸਾ ਉਤਸ਼ਾਹ ਦੇ ਕਾਰਨ ਹੀ ਅਸੀਂ ਉੱਚੀ ਆਵਾਜਾਂ ਲਗਾਉਂਦੇ ਹਾਂ ਜੋ ਕਿ ਸਾਨੂੰ ਅਸੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਇਸ ਨਾਚ ਵਿੱਚ ਕਰਦੇ ਹਾਂ ਜੋ ਕਿ ਢੋਲ ਦੀ ਟਾਪ 'ਤੇ ਅਸੀਂ ਆਵਾਜ਼ ਸਾਊਂਡ ਦਿਖਾਂਉਦੇ ਹਾਂ ਲੋਕਾਂ ਦਾ ਕਈਆਂ ਦਾ ਧਾਰਨਾ ਹੈ ਕਿ ਕੀ ਇਹ ਸਹੀ ਨਹੀਂ ਹੈ ਕਿਉਂਕਿ ਸਾਨੂੰ ਇਸ ਖੁਸ਼ੀ ਦਾ ਅਹਿਸਾਸ ਹੀ ਕਰਵਾਉਣਾ ਕਿ ਪੰਜਾਬ ਲੋਕ ਨ੍ਰਿਤ ਹੀ ਸਾਡਾ ਸਹੀ ਵਿਰਸੇ ਵਿੱਚ ਹੀ ਜਾਣਕਾਰੀ ਦੇਣੀ ਸਹੀ ਦੀ ਨੋਲੇਜ ਹੀ ਦੇਣੀ ਚਾਹੀਦੀ ਹੈ ਕਿ ਇੱਕ ਪੰਜਾਬੀ ਲੋਕ ਨਾਚ ਭੰਗੜਾ ਇੱਕ ਸਾਡਾ ਪੰਜਾਬੀ ਲੋਕ ਨ੍ਰਿਤ ਹੈ